ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਸਭ ਤੋਂ ਪਹਿਲਾਂ ਗੌਰਮੈਂਟ ਹਸਪਤਾਲ ਦੇ ਵਿੱਚ ਜੋ ਡਾਕਟਰ ਨੇ ਉਹਨਾਂ ਦੀ ਛੁੱਟੀ ਵਾਲੇ ਦਿਨ ਵੀ ਚੇਂਜ ਕਰਕੇ ਭਾਵ ਇੱਕ ਡਾਕਟਰ ਹਸਪਤਾਲ ਦੇ ਵਿੱਚ ਹੋਣਾ ਚਾਹੀਦਾ ਜਦੋਂ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਹਸਪਤਾਲ ਬੰਦ ਹੋਣ ਕਰਕੇ ਜਾਨੀ ਨੁਕਸਾਨ ਵੀ ਹੁੰਦਾ ਅਤੇ ਕਈਆਂ ਨੂੰ ਬਹੁਤ ਦੂਰ ਵੀ ਜਾਣਾ ਪੈਂਦਾ ਦੂਸਰੀ ਗੱਲ ਸਾਡੇ ਹਸਪਤਾਲ ਦੇ ਵਿੱਚ ਹੀ ਹਰ ਇੱਕ ਤਰ੍ਹਾਂ ਦੇ ਟੈਸਟ ਭਾਵ ਵਧੀਆ ਪੱਧਰ ਦੀਆਂ ਮਸ਼ੀਨਾਂ ਉੱਥੇ ਹੀ ਉਪਲਬਧ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਮਰੀਜ਼ ਦਾ ਸਮਾਂ ਅਤੇ ਉਸਦੀ ਜਾਨ ਵੀ ਬਚ ਸਕੇ ਅਤੇ ਗਰੀਬ ਲੋਕਾਂ ਨੂੰ ਹਰ ਸਹੂਲਤ ਫਰੀ ਦੇ ਵਿੱਚ ਵਧੀਆ ਦਵਾਈਆਂ ਵਧੀਆ ਮਸ਼ੀਨਾਂ ਰਾਹੀਂ ਉਹਨਾਂ ਦੇ ਟੈਸਟ ਕੀਤੇ ਜਾਣੇ ਚਾਹੀਦੇ ਹਨ